ਹੈਲੋ ਹਾਂਜੀ ਵਧੀਆ ਜੀ ਤੁਸੀਂ ਦੱਸੋ ਨਹੀਂ ਠੰਡ ਹੀ ਬਹੁਤ ਆ ਅਤੇ ਛੁੱਟੀਆਂ ਵੀ ਛੁੱਟੀਆਂ ਵੀ ਕਰਨੀਆਂ ਚਾਹੀਦੀਆਂ ਜਾਂ ਇਹਨਾਂ ਨੂੰ ਕਲਾਸ 'ਚ ਬਲੋਰ ਹੋਣ ਲਾਉਣੇ ਚਾਹੀਦੇ ਆ ਹੀਟਰ ਹੂਟਰ ਕਿਉਂਕਿ ਤੁਹਾਨੂੰ ਪਤਾ ਠੰਡ ਹੀ ਬਹੁਤ ਆ ਕੜਾਕੇ ਦੀ ਠੰਡ ਆ ਹਾਂ ਤੁਹਾਨੂੰ ਪਤਾ ਉਹ ਸੁੱਕੀ ਠੰਡ ਆ ਅਤੇ ਉਹ ਇਵੇਂ ਕਿ ਕੋਲਡ ਹੋ ਜੂਗਾ ਜਾ ਨਮੂਨੀਆ ਹੋ ਜਾਊਗਾ ਹਾਂ ਘੰਟਾ ਜਾਂ ਛੁੱਟੀਆਂ ਕਰ ਦਿਉ ਫਿਰ ਫੈਬ ਤੱਕ ਹਾਂ ਹਾਂਜੀ ਲੇਟ ਵੀ ਪਹੁੰਚਦੇ ਨਾਲੇ ਧੁੰਦ ਬਹੁਤ ਆ ਹਾਂਜੀ ਓਕੇ